ਪੰਜਾਬੀ ਭਾਸ਼ਾ ਇੱਕ ਬਹੁਤ ਲੰਬੇ ਸਮੇਂ ਤੋਂ ਵਿਕਾਸ ਕਰਦੀ ਕਰਦੀ ਅੱਜ ਦੇ ਦੌਰ ਵਿੱਚ ਪਹੁੰਚੀ ਹੈ ਪੰਜਾਬੀ ਭਾਸ਼ਾ ਨੇ ਹੋਰ ਸਾਰੀਆਂ ਭਾਸ਼ਾਵਾਂ ਤੋਂ ਵੀ ਬਹੁਤ ਸਾਰੇ ਸ਼ਬਦਾਂ ਨੂੰ ਆਪਣੇ ਵਿੱਚ ਸਮੋਅ ਲਿਆ ਹੈ ਅੱਜ ਕੱਲ੍ਹ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੇ ਖਾਸ ਕਰਕੇ ਅੰਗਰੇਜ਼ੀ ਦੇ ਸ਼ਬਦਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਣ ਲੱਗ ਪਈ ਹੈ ਬਹੁਤ ਸ ਜ਼ਿਆਦਾ ਸ਼ਬਦ ਇੱਦਾਂ ਦੇ ਨੇ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਇੰਨ ਬਿੰਨ ਸਮੋਅ ਲਿਆ ਗਿਆ ਹੈ ਖਾਸ ਕਰਕੇ ਟੈਕਨੀਕਲ ਭਾਸ਼ਾਵਾਂ ਦੇ ਜਾਂ ਟੈਕਨੀਕਲ ਸ ਵਿਸ਼ਿਆਂ ਸ ਦੇ ਜਿਹੜੇ ਸ਼ਬਦ ਨੇ ਉਨ੍ਹਾਂ ਲਈ ਪੰਜਾਬੀ ਭਾਸ਼ਾ ਵਿੱਚ ਉਨ੍ਹਾਂ ਸ਼ਬਦਾਂ ਨੂੰ ਇੰਨ ਬਿੰਨ ਹੀ ਬੋਲਿਆ ਜਾਂਦਾ ਹੈ ਜਿਵੇਂ ਕਿ ਪ੍ਰੋਗਰਾਮਿੰਗ ਜਿਹੜੀ ਹੈਗੀ ਹੈ ਪ੍ਰੋਗਰਾਮਿੰਗ ਦਾ ਪੰਜਾਬੀ ਵਿੱਚ ਕੋਈ ਖਾਸ ਰੱਝਵਾਂ ਨਹੀਂ ਹੋ ਸਕਦਾ ਉਸ ਨੂੰ ਅਸੀਂ ਪ੍ਰੋਗਰਾਮਿੰਗ ਹੀ ਬੋਲਾਂਗੇ ਇਸੇ ਤਰ੍ਹਾਂ ਕੰਪਿਊਟਰ ਨੂੰ ਕੰਪਿਊਟਰ ਹੀ ਕਿਹਾ ਜਾਂਦਾ ਹੈ ਪੰਜਾਬੀ ਦੇ ਵਿੱਚ ਜਦ ਕਿ ਕੰਪਿਊਟਰ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ